ਜੇਕਰ ਟਰੈਕਿੰਗ ਦੀ ਗੱਲ ਕਰੀਏ ਤਾਂ ਟਰੈਕਿੰਗ ਅੱਜ ਕੱਲ੍ਹ ਦੇ ਲੋਕਾਂ ਵਿੱਚ ਇੱਕ ਪ੍ਰਮੁੱਖ ਹੋਬੀ ਬਣਦਾ ਜਾ ਰਿਹਾ ਹੈ ਟਰੈਕਿੰਗ ਇੱਕ ਹੁਣ ਇੱਕ ਬਿਜਨਸ ਵੀ ਬਿਨਸ ਬਿਜਨਸ ਦਾ ਰੂਪ ਧਾਰਨ ਕਰ ਗਿਆ ਹੈ ਇਸ ਕਰਕੇ ਇਸ ਵਿੱਚ ਹੁਣ ਕਈ ਗਰੁੱਪਸ ਸ਼ਾਮਿਲ ਹੋ ਗਏ ਹਨ ਜਿਹੜੇ ਕਿ ਆਪਣੇ ਇੱਕ ਕੰਪਨੀ ਬਣਾ ਕੇ ਲੋਕਾਂ ਨੂੰ ਟਰੈਕਿੰਗ ਕਰਨ ਲਈ ਟਰੈਕਿੰਗ ਕਰਨ ਲਈ ਟਰੈਗਿੰਗ ਕਰਨ ਲਈ ਉਤਸ਼ਾਹ ਕਰਦੇ ਹਨ ਕਿ ਟਰੈਕਿੰਗ ਸ ਸਾਡੇ ਨਾਲ ਜੁੜਿਆ ਜਾਵੇ ਵੈਸੇ ਤਾਂ ਮੈਂ ਆਪਣੇ ਦੋਸਤਾਂ ਨਾਲ ਟਰੈਕਿੰਗ ਕਰਨ ਜਾਂਦਾ ਹਾਂ ਅਸੀਂ ਤਾਂ ਕਰਕੇ ਅਸੀਂ ਆਪਦਾ ਪ੍ਰਬੰਧ ਆਪ ਹੀ ਕਰਦੇ ਹਾਂ ਕਿਉਂਕਿ ਟਰੈਕਿੰਗ ਸਮੂਹਾਂ ਨਾਲ ਜੁੜਨ ਨਾਲ ਫਾਲਤੂ ਦਾ ਖਰਚਾ ਵੱਧ ਜਾਂਦਾ ਹੈ ਕਿਉਂਕਿ ਵੈਹ ਆਪਣੇ ਆਪਣੇ ਫਾਇਦੇ ਲਈ ਕਈ ਅਨਾਵਸ਼ਕ ਖਰਚ ਵੀ ਜੋੜ ਦਿੰਦੇ ਹਨ ਇਸ ਕਰਕੇ ਮੈਂ ਤਾਂ ਆਪਣੇ ਦੋਸਤਾਂ ਨਾਲ ਜਦੋਂ ਵੀ ਟਰੈਕਿੰਗ ਕਰਨ ਜਾਂਦਾ ਹਾਂ ਤਾਂ ਅਸੀਂ ਆਪਣਾ ਪ੍ਰਬੰਧ ਆਪ ਹੀ ਕਰਦੇ ਹਾਂ ਅਤੇ ਟਰੈਕਿੰਗ ਕਰਨਾ ਅੱਜ ਕੱਲ੍ਹ ਦੀ ਇੱਕ ਬਹੁਤ ਹੀ ਵ ਵੱਡੀ ਵੱਡੀ ਹੋਬੀ ਬਣਦਾ ਜਾ ਰਿਹਾ ਹੈ ਅਤੇ ਮੈਂ ਕੁਝ ਕੁਝ ਟਰੈਕ ਵੀ ਕੀਤੇ ਹਨ ਜਿਵੇਂ ਕਿ ਹਿਮਾਚਲ ਪ੍ਰਦੇਸ਼ ਵਿੱਚ ਵੀ ਇੱਕ ਦੋ ਟਰੈਕ ਹਨ ਅਤੇ ਮੇਰੀ ਟਰੈਕ ਲਿਸਟ ਵਿੱਚ ਅੱਗੇ ਵੀ ਇੱਕ ਦੋ ਨਾਮ ਹਨ ਜਿਵੇਂ ਕਿ ਹਿਮਾਚਲ ਪ੍ਰਦੇਸ਼ ਵਿੱਚ ਧਰਮਸ਼ਾਲਾ ਕੋਲ ਇੱਕ ਤ੍ਰਿਉਂਡ ਟਰੈਕ ਹੈ ਅਤੇ ਦ ਇੱਕ ਹੋਰ ਟਰੈਕ ਹਿਮਾਚਲ ਪ੍ਰਦੇਸ਼ ਵਿੱਚ ਹੈ ਜਿਸ ਦਾ ਨਾਮ ਹੈ ਖੀਰ ਗੰਗਾ ਉਹ ਹੈ ਉਹ ਹੈ ਇੱਕ ਬਹੁਤ ਹੀ ਵੱਡਾ ਅਤੇ ਥੋੜ੍ਹਾ ਚੁਣੌਤੀਪੂਰਨ ਚੁਣੌਤੀ ਭਰਿਆ ਟਰੈਕ ਹੈ ਜਿਸ ਵਿੱਚ ਬੜੀ ਸਾਵਧਾਨੀ ਨਾਲ ਟਰੈਕਿੰਗ ਕਰਨਾ ਟਰੈਕਿੰਗ ਕਰਨੀ ਪੈਂਦੀ ਹੈ ਅਤੇ ਗਾਈਡ ਦੀ ਜਿਸ ਵਿੱਚ ਅਵਸ਼ਕਤਾ ਪੈਂਦੀ ਹੈ ਇਸ ਕਰਕੇ ਮੈਂ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਫਰੀ ਹੋਵਾਂਗਾ ਤਾਂ ਇਹਨਾਂ ਟਰੈਕਾਂ 'ਤੇ ਜ਼ਰੂਰ ਜਾਣਾ ਚਾਹਾਂਗਾ ਧੰਨਵਾਦ